ਅਸੀਂ ਕੱਪੜੇ ਧੋਣ ਲਈ ਜ਼ਿਆਦਾਤਰ ਵਾਸ਼ਿੰਗ ਮਸ਼ੀਨ ਦੀ ਵਰਤੋਂ ਕਰਦੇ ਹਾਂ ਜੇ ਕਈ ਵਾਰ ਘਰਾਂ ਦੇ ਵਿੱਚ ਲੈਟ ਨਾ ਹੋਵੇ ਤਾਂ ਅਸੀਂ ਹੱਥੀਂ ਧੋਣ ਦੀ ਵੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੇ ਮਾਤਾ ਪਿਤਾ ਨਾਲ ਵੀ ਸਕਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅਸੀਂ ਮਸ਼ੀਨ ਦੇ ਵਿੱਚ ਚੰਗੀ ਸਰਫ ਦੀ ਵਰਤੋਂ ਕਰਦੇ ਹਾਂ ਅਤੇ ਆਪਣੀ ਮਾਤਾ ਦੇ ਨਾਲ ਹੈਲਪ ਕਰਨ ਦੇ ਵਿੱਚ ਮਦਦ ਕਰਦੇ ਹਾਂ ਅਤੇ ਕਈ ਵਾਰ ਅ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਅਸੀਂ ਕੱਪੜੇ ਸੁਕਾਉਣ ਲਈ ਕਈ ਵਾਰ ਕੋਠੇ ਦੇ ਉੱਪਰ ਸੁਕਾਉਣਾ ਪੈਂਦੇ ਹਨ ਕੱਪੜੇ ਜਿਵੇਂ ਜਿਵੇਂ ਸਰਦੀਆਂ ਦੇ ਵਿੱਚ ਧੁੱਪ ਨਾ ਹੋਣ ਕਰਕੇ ਉੱਪਰ ਕੱਪੜੇ ਸੁਕਾਉਣੇ ਪੈਂਦੇ ਹਨ ਅਤੇ ਕਈ ਵਾਰ ਸਾਨੂੰ ਕੱਪੜਿਆਂ ਨੂੰ ਆਪਣੇ ਆਂਗਨ ਦੇ ਵਿੱਚ ਜਾ ਕੇ ਵੀ ਕੱਪੜਿਆਂ ਨੂੰ ਵਿਹੜੇ ਦੇ ਵਿੱਚ ਜਾ ਕੇ ਵੀ ਆਪਣੇ ਕੱਪੜਿਆਂ ਨੂੰ ਅ ਟੰਗਣੀ ਦੇ ਉੱਪਰ ਸੁਕਾਏ ਜਾ ਸਕਦੇ ਹਨ ਅਤੇ ਇਸ ਅ ਇਸ ਪ੍ਰਕਾਰ ਅਸੀਂ ਵਾਸ਼ਿੰਗ ਮਸ਼ੀਨ ਦੀ ਵਰਤੋਂ ਨੂੰ ਅੱਛੀ ਤਰ੍ਹਾਂ ਸੁਕਾਉਂਦੇ ਰਹਿੰਦੇ ਹਾਂ ਅਤੇ ਆਪਣੀ ਮਾਤਾ ਪਿਤਾ ਅਤੇ ਆਪਣੀ ਫੈਮਲੀ ਦੇ ਨਾਲ ਕੱਪੜਿਆਂ ਦੀ ਵਰਤੋਂ ਉਤੇ ਸੁਕਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਅ ਰਹਿਦੇ ਹਾਂ ਅਤੇ ਵਾਸ਼ਿੰਗ ਮਸ਼ੀਨ ਦੇ ਹੋਰ ਵੀ ਫਾਇਦੇ ਹਨ ਜਿਵੇਂ ਕਿ ਵਾਸ਼ਿੰਗ ਮਸ਼ੀਨ ਨਾਲ ਨੇ ਜਿਹੜਾ ਕੱਪੜੇ ਦਾ ਨਿਖ਼ਾਰ ਵਧੀਆ ਆਉਂਦਾ ਹੈ ਅਤੇ ਕੱਪੜਿਆਂ ਦੇ ਵਿੱਚ ਸ਼ਾਈਨਿੰਗ ਵਧੀਆ ਹੁੰਦੀ ਹੈ ਵਧੀਆ ਸਾਫ਼ ਸੁਥਰਾ ਹੁੰਦਾ ਹੈ ਅਤੇ ਅਤੇ ਇਸ ਤੋਂ ਬਾਅਦ ਅਸੀਂ ਬੱਚਿਆਂ ਨਾਲ ਬੱਚਿਆਂ ਨੂੰ ਵੀ ਇਹ ਬੱਚਿਆਂ ਨੂੰ ਔਰ ਮਾਤਾ ਪਿਤਾ ਔਰ ਔਰ ਔਰ ਫੈਮਲੀ ਦੇ ਮੈਂਬਰਾਂ ਨੂੰ ਵੀ ਮਸ਼ੀਨ ਔਰ ਸੁਕਾਉਣ ਦੇ ਸਹੀ ਢੰਗ ਨੂੰ ਸਹੀ ਢੰਗ ਨੂੰ ਵੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹਾਂ ਅਤੇ ਇਸ ਪ੍ਰਕਾਰ ਇਹ ਸਥਿਤੀਆਂ ਦੇ ਵਿੱਚ ਅਸੀਂ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ